ਸਾਡੇ ਖੇਤਰ ਵਿੱਚ ਹਾਲ ਹੀ ਤੌਰ 'ਤੇ ਬੇਹਤਰੀ ਇਹ ਹੋਈ ਹੈ ਕਿ ਮਹੱਲਾ ਕਲੀਨਿਕ ਖੁੱਲ੍ਹ ਗਏ ਨੇ ਮਹੱਲਾ ਕਲੀਨਿਕ ਦੇ ਵਿੱਚ ਤੁਸੀਂ ਆਪਣਾ ਨੰਬਰ ਅਧਾਰ ਕਾਰਡ ਦਿਖਾਉਣਾ ਹੈ ਅਤੇ ਤੁਹਾਨੂੰ ਇੱਥੇ ਟੈਸਟ ਵੀ ਫਰੀ ਹੁੰਦੇ ਨੇ ਚੈੱਕਅਪ ਵੀ ਫਰੀ ਹੁੰਦਾ ਅਤੇ ਮੈਜ਼ ਮੈਡੀਸਨ ਵੀ ਫਰੀ ਮਿਲਦੀ ਹੈ ਅਤੇ ਬਹੁਤ ਪਿਆਰ ਨਾਲ ਡੀਲ ਕਰਦੇ ਨੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਇਹ ਬਿਹਤਰੀ ਬਹੁਤ ਅੱਛੀ ਹੈ ਮੈਂ ਜ਼ਿਆਦਾਤਰ ਮੇਰੇ ਮਦਰ ਬਿਮਾਰ ਰਹਿੰਦੇ ਨੇ ਅਤੇ ਮੇਰੇ ਰਜਿੰਦਰਾ ਦੇ ਵਿੱਚ ਚੱਕਰ ਜਿਹੜੇ ਨੇ ਉਹ ਲੱਗਦੇ ਰਹਿੰਦੇ ਨੇ ਪਟਿਆਲਾ ਰਜਿੰਦਰਾ ਹੋਸਪੀਟਲ ਉੱਥੇ ਮੈਂ ਇਹ ਸੁਧਰਿਆ ਹੋਇਆ ਅਤੇ ਬਦਲਿਆ ਹੋਇਆ ਦੇਖਿਆ ਕਿ ਉੱਥੇ ਸਫ਼ਾਈ ਹੀ ਹੁਣ ਕਾਫ਼ੀ ਜ਼ਿਆਦਾ ਹੈ ਪਹਿਲਾਂ ਬਹੁਤ ਗੰਦਗੀ ਹੁੰਦੀ ਸੀ ਅਤੇ ਡਾਕਟਰ ਪਰੋਪਰ ਟਾਈਮ 'ਤੇ ਆਉਂਦੇ ਨੇ ਪਰੋਪਰ ਟਾਈਮ 'ਤੇ ਲਾਸਟ ਤੱਕ ਐਂਡ ਤੱਕ ਸਾਰੇ ਪੇਸ਼ੈਂਟ ਦੇਖ ਕੇ ਫਿਰ ਜਾਂਦੇ ਨੇ ਇਹ ਚੀਜ਼ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਇਸ ਚੀਜ਼ ਨਾਲ ਮੈਂ ਹੋਰ ਚੀਜ਼ਾਂ ਦੇਖੀਆਂ ਕਿ ਉੱਥੇ ਨਵੀਆਂ ਬਿਲਡਿੰਗ ਡਵੈਲਪ ਹੋਈਆਂ ਨੇ ਬਿਲਡਿੰਗ ਦੇ ਵਿੱਚ ਨਵੇਂ ਸਪੈਸ਼ਲਟੀ ਵਾਰਡਸ ਖੁੱਲ੍ਹੇ ਨੇ ਮੈਂ ਕਾਫ਼ੀ ਚੇਜਿਸ ਦੇਖੇ ਨੇ ਹੁਣ ਦੇ ਟਾਈਮ ਤੋਂ ਲੈ ਕੇ ਬਾਅਦ ਦੇ ਟਾਈਮ ਤੱਕ ਸੋ ਇਹ ਚੀਜ਼ਾਂ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਬਹੁਤ ਚੰਗਾ ਲੱਗਿਆ